ਮੈਨੇ ਆਪਣੇ ਦੋਸਤ ਹਾਰਿਸ਼ ਕੁਮਾਰ ਦੇ ਬਰਡੇ 'ਤੇ ਉਸ ਨੂੰ ਤੋਹਫ਼ੇ ਵਿੱਚ ਇੱਕ ਕਵਿਤਾ ਲਿਖ ਕੇ ਦਿੱਤੀ ਸੀ ਠੀਕ ਹੈ ਕਵਿਤਾ ਲਿਖਣ ਦਾ ਮੈਨੂੰ ਸ਼ੌਂਕ ਬਹੁਤ ਪਹਿਲਾਂ ਤੋਂ ਹੀ ਸੀ ਜਦੋਂ ਮੈਂ ਪਹਿਲੀ ਦੂਜੀ ਕਲਾਸ ਵਿੱਚ ਪੜ੍ਹਦਾ ਸੀ ਉਦੋਂ ਤੋਂ ਹੀ ਮੈਨੂੰ ਕਵਿਤਾ ਲਿਖਣ ਦਾ ਸ਼ੌਕ ਪੈ ਗਿਆ ਸੀ ਮੈਨੇ ਇੱਕ ਦਿਨ ਸੋਚਿਆ ਇੱਕ ਦਿਨ ਮੇਰੇ ਫਰੈਂਡ ਦਾ ਬਰਡੇ ਸੀ ਉਸ ਦਿਨ ਮੈਂ ਸੋਚਿਆ ਵੀ ਮੈਂ ਆਪਣੇ ਫਰੈਂਡ ਨੂੰ ਬਰਡੇ ਦੇ ਵਿੱਚ ਕੀ ਉਪਹਾਰ ਦੇ ਸਕਦਾ ਹਾਂ ਉਸਨੂੰ ਮੇਰੀ ਲਿਖੀ ਹੋਏ ਕਾਵਿ ਗਦ ਬਹੁਤ ਹੀ ਜ਼ਿਆਦਾ ਪਸੰਦ ਸਾ ਠੀਕ ਹੈ ਤੋ ਮੈਨੇ ਸੋਚਿਆ ਵੀ ਮੈਂ ਉਸਨੂੰ ਆਪਣੇ ਹੱਥਾਂ ਲਾਈ ਆਪਣੀ ਭਾਵਨਾ ਉਸ ਕਾਵਿ ਜਾ ਗੱਦ ਰਾਹੀ ਉਸ ਅੱਗੇ ਪ੍ਰਗਟ ਕਰਾਂ ਜਦੋਂ ਮੈਂ ਉਸਨੂੰ ਉਸ ਤੋਫ ਜਨਮ ਦਿਨ ਦੇ ਤੋਹਫ਼ੇ 'ਤੇ ਉਹ ਕਾਵਿ ਜਾਂ ਗਦ ਲਿਖ ਕੇ ਦਿੱਤਾ ਤਾਂ ਉਹ ਇੰਨਾ ਜ਼ਿਆਦਾ ਖੁਸ਼ ਹੋਇਆ ਉਸ ਕਾਵਿ ਜਾਂ ਗਦ ਨੂੰ ਸੁਣ ਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹਨੂੰ ਇੰਨਾ ਜ਼ਿਆਦਾ ਪਸੰਦ ਆਇਆ ਮੇਰਾ ਮਿੱਤਰ ਹੈ ਹਰਸ਼ ਮੇਰਾ ਮਿੱਤਰ ਹੈ ਹਰਸ਼ ਇਹ ਕਵਿਤਾ ਦਾ ਸਾਰਿਆਂ ਨਾਲੋਂ ਉੱਪਰਲਾ ਭਾਗ ਸੀ ਮੇਰਾ ਜੋ ਮੈਨੇ ਲਿਖਿਆ ਸੀ ਆਪਣੇ ਮਾਧਿਅਮ ਵੀ ਮੇਰਾ ਮਿੱਤਰ ਹੈ ਹਰਸ਼